ਮੈਂ ਪਹਿਲੀ ਵਾਰ ਜਦੋਂ ਸ਼ੋਪਿੰਗ ਕੀਤੀ ਸੀ ਔਨਲਾਈਨ ਸ਼ੋਪਿੰਗ ਕੀਤੀ ਸੀ ਤਾਂ ਮੈਂ ਆਪਣੇ ਲਈ ਇੱਕ ਕੋਟਨ ਦਾ ਕੁੜਤਾ ਆਰਡਰ ਕੀਤਾ ਸੀ ਜਿਹਦੀ ਜਿਹੜਾ ਕਿ ਮੈਂ ਐਮਾਜ਼ਾਨ ਤੋਂ ਆਰਡਰ ਕੀਤਾ ਸੀ ਜਿਹਦੀ ਕਿ ਰਾਸ਼ੀ ਜਿਹੜੀ ਹੈ ਉਹ ਛੇ ਸੌ ਛਿਹੱਤਰ ਰੁਪਏ ਸੀ ਔਰ ਉਸ ਉਹ ਕੁੜਤਾ ਜਦੋਂ ਆਇਆ ਤਾਂ ਮੈਨੂੰ ਪਹਿਲਾਂ ਤਾਂ ਡਰ ਲੱਗ ਰਿਹਾ ਸੀ ਕਿ ਮੈਂ ਪਹਿਲੀ ਵਾਰੀ ਆਨਲਾਈਨ ਸ਼ਾਪਿੰਗ ਕਰ ਰਹੀ ਹਾਂ ਪਤਾ ਨਹੀਂ ਕਿਵੇਂ ਦਾ ਐਕਸਪੀਰੀਅੰਸ ਰਹੂਗਾ ਕਿਵੇਂ ਦਾ ਕੱਪੜਾ ਆਊਗਾ ਜਾਂ ਰਿਸੀਵ ਹੋਊਗਾ ਜਾਂ ਨਹੀਂ ਹੋਊਗਾ ਇਹ ਵੀ ਡਰ ਸੀ ਮੈਨੂੰ ਪਰ ਜਦੋਂ ਉਹ ਆਰਡਰ ਮੈਨੂੰ ਰਿਸੀਵ ਹੋਇਆ ਮੈਂ ਖੋਲ੍ਹ ਕੇ ਦੇਖਿਆ ਮੈਂ ਪੇਮੈਂਟ ਜਿਹੜੀ ਆ ਕੈਸ਼ ਔਨ ਡਿਲੀਵਰੀ ਸਲੈਕਟ ਕੀਤੀ ਸੀ ਮੈਂ ਪੇਮੈਂਟ ਵੀ ਕਰ ਦਿੱਤੀ ਅਤੇ ਪੇਮੈਂਟ ਕਰਨ ਤੋਂ ਬਾਅਦ ਜਦੋਂ ਮੈਂ ਖੋਲ੍ਹ ਕੇ ਦੇਖਿਆ ਉਸ ਪ੍ਰੋਡਕਟ ਨੂੰ ਉਸ ਕੁੜਤੇ ਨੂੰ ਤਾਂ ਮੇਰਾ ਮਨ ਬਹੁਤ ਖੁਸ਼ ਹੋਇਆ ਕਿਉਂਕਿ ਉਸ ਪ੍ਰੋਡਕਟ ਦਾ ਉਸ ਕੁੜਤੇ ਦਾ ਮਤਲਬ ਜਿਹੜਾ ਕਲਰ ਸੀਗਾ ਉਹ ਵੀ ਬਹੁਤ ਅੱਛਾ ਆਇਆ ਸੀ ਜੋ ਮੈਨੂੰ ਦਿਖਾਇਆ ਗਿਆ ਸੀ ਫੋਟੋ ਦੇ ਵਿੱਚ ਉਹ ਉਵੇਂ ਦਾ ਹੀ ਆਇਆ ਸੀ ਔਰ ਉਹਦਾ ਜਿਹੜਾ ਕੱਪੜਾ ਸੀ ਲਿਖਿਆ ਹੋਇਆ ਸੀ ਕਾਟਨ ਦਾ ਔਰ ਕੋਟਨ ਦਾ ਹੀ ਸੀ ਉਹ ਉਹਦਾ ਜਿਹੜਾ ਉਸ 'ਤੇ ਜੋ ਕਢਾਈ ਦਿਖਾਈ ਹੋਈ ਸੀ ਫੋਟੋ ਦੇ ਵਿੱਚ ਉਹ ਵੀ ਐਜ਼ ਇਟ ਇਜ਼ ਆਈ ਸੀ ਜਿਵੇਂ ਦਾ ਜੋ ਪ੍ਰੋਡਕਟ ਮੈਨੂੰ ਐਮਾਜ਼ੋਨ 'ਤੇ ਦਿਖਾਇਆ ਗਿਆ ਸੀ ਕਿ ਇੱਦਾਂ ਆਊਗਾ ਉਹ ਉਸ ਅਕੋਰਡਿੰਗ ਹੀ ਆਇਆ ਸੀ ਮੈਂ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਸਮਾਲ ਸਾਈਜ਼ ਦਾ ਮੰਗਾਇਆ ਸੀ ਕੁੜਤਾ ਮੰਗਾ ਕੇ ਦੇਖਿਆ ਸੀ ਕਿ ਸ਼ਾਇਦ ਆਊਗਾ ਜਾਂ ਨਹੀਂ ਆਊਗਾ ਪਰ ਜਦੋਂ ਮੈਂ ਪਾ ਕੇ ਦੇਖਿਆ ਤਾਂ ਉਹ ਬਹੁਤ ਅੱਛਾ ਆਇਆ ਮੇਰੇ ਬਹੁਤ ਵਧੀਆ ਫਿੱਟ ਆਈ ਉਹਦੀ ਤਾਂ ਜਿਹੜਾ ਮੇਰਾ ਫਸਟ ਐਕਸਪੀਰੀਅੰਸ ਸੀਗਾ ਪਹਿਲਾ ਪ੍ਰੋਡਕਟ ਮੰਗਾਉਣ ਦਾ ਐਕਸਪੀਰੀਅੰਸ ਜੇ ਜਿਹੜਾ ਸੀਗਾ ਉਹ ਮੇਰੇ ਲਈ ਬਹੁਤ ਵਧੀਆ ਰਿਹਾ ਤਾਂ ਉਸ ਤੋਂ ਬਾਅਦ ਫਿਰ ਮੈਨੂੰ ਮੇਰਾ ਡਰ ਖਤਮ ਹੋ ਗਿਆ ਕਿ ਔਨਲਾਈਨ ਸ਼ਾਪਿੰਗ ਵੀ ਕੀਤੀ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਮੈਂ ਹੁਣ ਲਗਾਤਾਰ ਔਨਲਾਈਨ ਸ਼ਾਪਿੰਗ ਜਿਹੜੀ ਹਾਂ ਕਰ ਰਹੀ ਹਾਂ